ਸਾਡੇ ਧਰਮ ਦਾ ਅਧਿਐਨ ਕਰਨਾ ਸ ਸਕੂਲ ਦੇ ਪਾਠਕ੍ਰਮ ਦਾ ਹਿੱਸਾ ਹੈ ਇਸ ਨਾਲ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਉਂਦੀ ਹੈ ਬੱਚਿਆਂ ਨੂੰ ਪਾਠਕ੍ਰਮ ਵਿੱਚ ਪੜ੍ਹਾਇਆ ਜਾਂਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਨਾਲ ਕੀ ਸਾਡੇ ਅੰਦਰ ਤਬਦੀਲੀ ਆਉਂਦੀ ਹੈ ਅਸੀਂ ਦੁਨੀਆ 'ਤੇ ਕਿਸ ਕੰਮ ਕਰਨ ਵਾਸਤੇ ਆਏ ਹਾਂ ਅਤੇ ਚੰਗੇ ਕਰਮ ਕਰਨੇ ਹਮੇਸ਼ਾ ਚਾਹੀਦੇ ਹਨ ਕਿਸੇ ਦਾ ਮਾੜਾ ਸ ਵਗੈਰਾ ਨਹੀਂ ਸੋਚਣਾ ਚਾਹੀਦਾ ਜਿਸ ਕਰਕੇ ਇਸ ਪਾਠਕ੍ਰਮ ਨੂੰ ਪੜ੍ਹ ਕੇ ਸਾਡੇ ਮਨਾਂ ਦੇ ਉੱਤੇ ਕਾਫੀ ਡੂੰਘਾ ਪ੍ਰਭਾਵ ਪੈਂਦਾ ਹੈ ਇਸ ਪਾਠਕ੍ਰਮ ਰਾਹੀਂ ਧਰਮ ਬਾਰੇ ਜੋ ਲਿਖਿਆ ਜਾਂਦਾ ਉਹ ਬੱਚਿਆਂ ਦੇ ਉੱਤੇ ਵੀ ਕਾਫੀ ਪ੍ਰਭਾਵ ਪੈਂਦਾ ਬੱਚਿਆਂ ਦੇ ਹੀ ਨਹੀਂ ਬਾਕੀ ਸਾਰੇ ਸਮਾਜ 'ਤੇ ਵੀ ਇਸ ਦਾ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ ਜਿਸ ਕਰਕੇ ਇਸਦਾ ਲੋਕਾਂ ਦਾ ਨਜ਼ਰੀਆ ਵੀ ਬਦਲ ਜਾਂਦਾ ਹੈ ਇਸ ਨਾਲ ਸਾਡੇ ਧਰਮ ਨਾਲ ਸਾਡੇ ਜੀਵਨ ਦਾ ਕਾਫੀ ਸੁਧਾਰ ਹੁੰਦਾ ਹੈ